ਮੈਂ ਇਹ ਸੋਚਦਾ ਹਾਂ ਕਿ ਡਾਂਸ ਲੋਕਾਂ ਨੂੰ ਇਕੱਠੇ ਲਿਆ ਸਕਦਾ ਹੈ ਲੋਕਾਂ ਵਿੱਚ ਪ੍ਰੇਮ ਪਿਆਰ ਵਧਾ ਸਕਦਾ ਹੈ ਇਸ ਨਾਲ ਲੋਕ ਹੋਰ ਲੋਕਾਂ ਨਾਲ ਜਾਣੂ ਹੁੰਦੇ ਹਨ ਲੋਕਾਂ ਦੇ ਫਰੈਂਡ ਸਰਕਲ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਲੋਕਾਂ ਦੀ ਜਾਣ ਪਛਾਣ ਵੱਧਦੀ ਹੈ ਜਿਵੇਂ ਕਿ ਦੇਖਿਆ ਜਾਵੇ ਜਦੋਂ ਕੋਲਜਾਂ ਵਿੱਚ ਜਾਂ ਸਕੂਲਾਂ ਵਿੱਚ ਭੰਗੜਾ ਪ੍ਰਫੋਰਮੈਂਸ ਹੁੰਦੀ ਹੈ ਕਿਸੇ ਫੰਕਸ਼ਨ ਲਈ ਤਾਂ ਸਾਰੇ ਮੁੰਡੇ ਕੁੜੀਆਂ ਇਕੱਠੇ ਹੋ ਕੇ ਉਹ ਵੀ ਇਕੱਠੇ ਹੋ ਜਾਂਦੇ ਹਨ ਜਿਹੜੇ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੁੰਦੇ ਜਦੋਂ ਨਵੇਂ ਨਵੇਂ ਆਉਂਦੇ ਹਨ ਇੱਕ ਦੂਜੇ ਦੇ ਨਾਲ ਪਹਿਲਾਂ ਜਾਂਚ ਪੜਤਾਲ ਕਰਕੇ ਇੰਟਰੋਡਕਸ਼ਨ ਕਰਦੇ ਹਨ ਫਿਰ ਯਾਰ ਮਿੱਤਰ ਬਣ ਕੇ ਬੜੇ ਵਧੀਆ ਤਰੀਕੇ ਨਾਲ ਮਾਹੌਲ ਬਣਾ ਕੇ ਪ੍ਰੈਕਟਿਸ ਕਰਦੇ ਹਨ ਫਿਰ ਸਟੇਜ 'ਤੇ ਪਰਫੋਰਮੈਂਸ ਕਰਦੇ ਹਨ ਉਹ ਯਾਦਾਂ ਉਮਰ ਭਰ ਲਈ ਬਣ ਜਾਂਦੀਆਂ ਹਨ ਭੰਗੜਾ ਗਿੱਧਾ ਜਾਂ ਹੋਰ ਵੀ ਅਗਰ ਡਾਂਸ ਦੇਖਿਆ ਜਾਵੇ ਇਹ ਲੋਕਾਂ ਨੂੰ ਇਕੱਠੇ ਕਰਦਾ ਹੈ ਉਹਨਾਂ ਵਿੱਚ ਪਿਆਰ ਵਧਾਉਂਦਾ ਹੈ ਅਤੇ ਹੋਰ ਕਲਚਰਸ ਨੂੰ ਵੀ ਰੀਪ੍ਰਜੈਂਟ ਕਰਦਾ ਹੈ ਪੰਜਾਬ ਦਾ ਕਲਚਰ ਭੰਗੜਾ ਗਿੱਧਾ ਬਹੁਤ ਜ਼ਿਆਦਾ ਅੱਜ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਅਤੇ ਸਾਰੇ ਲੋਕ ਇਸਦਾ ਆਨੰਦ ਮਾਣਦੇ ਹਨ ਅੱਜ ਦੀ ਡੇਟ ਵਿੱਚ ਭੰਗੜਾ ਅਤੇ ਗਿੱਧਾ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਜਾ ਚੁੱਕੇ ਹਨ ਜਿਵੇਂ ਕਿ ਕੈਨੇਡਾ ਅਤੇ ਅਮੈਰੀਕਾ ਦੇ ਵਿੱਚ ਬਹੁਤ ਸਾਰੇ ਭੰਗੜਾ ਟੀਮਜ ਅਤੇ ਇੰਸਟੀਟਿਊਟਸ ਵੀ ਹਨ ਜਿਹੜੇ ਭੰਗੜਾ ਸਿਖਾਉਂਦੇ ਹਨ ਸੋ ਡਾਂਸ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਫਰੀ ਸਮੇਂ ਤੋਂ ਛੱਡ ਕੇ ਆਪਣਾ ਧਿਆਨ ਦੇਵਰਟ ਕਰਕੇ ਡਾਂਸ ਕਰਦੇ ਹਨ ਉਹਨਾਂ ਨਾਲ ਉਹਨਾਂ ਦਾ ਮਾਇੰਡ ਰਿਲੈਕਸ ਹੁੰਦਾ ਹੈ ਕੰਮਾਂ ਕਾਰਾਂ ਦੀ ਟੈਂਸ਼ਨਾਂ ਤੋਂ ਛੱਡ ਕੇ ਉਹ ਡਿਪਰੈਸ਼ਨ ਕਈ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਉਹਨਾਂ ਨਾਲ ਉਹਨਾਂ ਦੀ ਬੋਡੀ ਡਾਂਸ ਕਰਨਾ ਉਹਨਾਂ ਦੀ ਬੋਡੀ ਰਿਲੈਕਸ ਹੁੰਦੀ ਹੈ ਅਤੇ ਉਹ ਮੋਟੀਵੇਟਿਡ ਫੀਲ ਕਰਦੇ ਹਨ ਅਤੇ ਥੋੜ੍ਹਾ ਜਿਹਾ ਪੇਸ਼ੈਂਸ ਐਂਡ ਰਿਲੈਕਸ ਫੀਲ ਕਰਦੇ ਹਨ ਸੋ ਡਾਂਸ ਬਹੁਤ ਜ਼ਰੂਰੀ ਹੈ ਅਤੇ ਬਹੁਤ ਵਧੀਆ ਰੋਲ ਪਲੇਅ ਕਰਦਾ ਹੈ ਹਰ ਇੱਕ ਦੀ ਲਾਈਫ ਦੇ ਵਿੱਚ ਸੋ ਸਾਰਿਆਂ ਨੂੰ ਹੀ ਡਾਂਸ ਕਰਨਾ ਚਾਹੀਦਾ ਹੈ ਐਂਡ ਇਹ ਭਾਈਚਾਰੇ ਦੀ ਭਾਵਨਾ ਨੂੰ ਵੀ ਵਧਾ ਸਕਦਾ ਹੈ